ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾਤਰ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਹਨ ਜੇਕਰ ਮੈਂ ਗੱਲ ਉਹਨਾਂ ਵਿੱਚੋਂ ਇੱਕ ਗੱਲ ਕਰਾਂ ਜਿਵੇਂ ਕਿ ਗੇਮਾਂ ਵਿੱਚ ਮੇਰੇ ਮੈਂ ਛੇਵੀਂ ਤੋਂ ਫੁੱਟਬੋਲ ਖੇਡਦਾ ਸੀ ਜੋ ਕਿ ਮੇਰੀ ਇੱਕ ਚੀ ਇੱਕ ਸਭ ਤੋਂ ਵਧੀਆ ਗੇਮ ਹੈ ਅਤੇ ਉਹ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ ਕਿ ਸਾਡੇ ਅਸੀਂ ਜ਼ਿਆਦਾਤਰ ਮੈਂ ਉਹ ਗੇਮ ਆਪਣੇ ਸਕੂਲ ਵੱਲੋਂ ਖੇਡਦਾ ਰਿਹਾ ਹਾਂ ਅਤੇ ਉਸ ਗੇਮ ਦੇ ਬਹੁਤ ਹੀ ਫਾਇਦੇ ਹਨ ਉਹ ਬੰਦੇ ਨੂੰ ਫਿੱਟ ਰੱਖਦੀ ਹੈ ਅਤੇ ਇਸਦੇ ਨਾਲ ਮੇਰੀ ਅ ਜਿਹੜਾ ਸਰੀਰ ਹੈ ਉਹ ਤੰਦਰੁਸਤ ਰਹਿੰਦਾ ਸੀ ਅਤੇ ਮੈਂ ਆਪਣੇ ਸਕੂਲ ਵੱਲੋਂ ਬਹੁਤ ਜਗ੍ਹਾ 'ਤੇ ਖੇਡਣ ਗਿਆ ਹਾਂ ਹਰੇ ਜ਼ੋਨ ਡਿਸਟ੍ਰਿਕ ਸਟੇਟ ਅਤੇ ਕਲੱਸਟਰ ਇਸ ਤੋਂ ਬਾਅਦ ਅਸੀਂ ਹਰ ਸਾਲ ਆਪਣੇ ਸਕੂਲ ਵੱਲੋਂ ਦ ਹਰੇਕ ਸਟੇਟ 'ਚ ਵਿੱਚ ਖੇਡਣ ਜਾਂਦੇ ਸੀ ਜੋ ਕਿ ਸਾਡੇ ਲਈ ਬਹੁਤ ਹੀ ਵਧੀਆ ਮੇਰੇ ਲਈ ਬਹੁਤ ਹੀ ਵੱਡੀ ਪ੍ਰਾਪਤੀ ਹਨ ਅਤੇ ਮੈਨੂੰ ਸਕੂਲ ਵੱਲੋਂ ਕਈ ਵਾਰ ਮੈਡਲ ਵੀ ਦਿੱਤਾ ਗਿਆ ਹੈ ਅਤੇ ਮੈਂ ਆਪਣੇ ਆਪ 'ਤੇ ਬਹੁਤ ਮਾਣ ਮਹਿਸੂਸ ਕਰਦਾ ਹਾਂ ਕਿ ਮੈਨੂੰ ਐਨੀ ਸੋਹਣੀ ਗੇਮ ਜੋ ਕਿ ਮੇਰੀ ਐਨੀ ਸੋਹਣੀ ਗੇਮ ਮੈਨੂੰ ਪਸੰ ਫੁੱਟਬਾਲ ਹੈ